ਸਮਾਜ ਦੇ ਵਿੱਚ ਖੇਡਾਂ ਦਾ ਬਹੁਤ ਮਹੱਤਵ ਹੈ ਅਤੇ ਮੇਰਾ ਇਹ 'ਤੇ ਇਹੀ ਵਿਚਾਰ ਹੈ ਕਿ ਖੇਡਾਂ ਨੂੰ ਸਾਨੂੰ ਵਧਾਉਣਾ ਚਾਹੀਦਾ ਹੈ ਖੇਡਾਂ ਕਈ ਜਗ੍ਹਾ 'ਤੇ ਲੁਪਤ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਕਿ ਕਬੱਡੀ ਕੁਸ਼ਤੀ ਖੋ ਖੋ ਕਬੱਡੀ ਨੂੰ ਖੇਡ ਕੇ ਸਾਡਾ ਜਿਹੜਾ ਹੈ ਸਾਡੀ ਸ਼ ਮਸਲ ਮਾਸ ਵਧਦਾ ਹੈ ਅਤੇ ਅਸੀਂ ਆਪਣੇ ਸਰੀਰ ਦੇ ਵਿੱਚ ਹੋਰ ਜ਼ਿਆਦਾ ਮਜਬੂਤੀ ਲਿਆ ਸਕਦੇ ਹਾਂ ਕੁਸ਼ਤੀ ਨਾਲ ਕੁਸ਼ਤੀ ਦੇ ਵਿੱਚ ਵੀ ਆਹੀ ਹੁੰਦਾ ਹੈ ਅਤੇ ਖੋ ਖੋ ਖੇਡ ਕੇ ਅਸੀਂ ਆਪਣੇ ਆਪ ਨੂੰ ਆਪਣੇ ਆਪ ਦਾ ਸ ਦਾ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਅਸੀਂ ਹੋਰ ਤੇਜ ਭੱਜ ਸਕਦੇ ਹਾਂ ਕਿ ਦੂਜੇ ਤੋਂ ਕਿੱਦਾਂ ਬਚਣਾ ਆ ਕਿ ਦੂਜੇ ਬੰਦੇ ਤੋਂ ਹੱਥ ਨਹੀਂ ਲੱਗਣ ਦੇਣਾ ਕਿੱਦਾਂ ਬਚਣਾ ਆ ਉਹ ਤੋਂ ਕਿਹੜੀ ਜਗ੍ਹਾ ਤੋਂ ਕਿੱਥੋਂ ਆਪਣੇ ਆਪ ਦੇ ਜਿਹੜੇ ਓਪੀਨੀਅਨ ਹੈ ਉਹ ਸਟਰੋਂਗ ਕਰਨ 'ਚ ਹੈਲਪ ਕਰਦਾ ਆ ਅਤੇ ਖੇਡਾਂ ਦੇ ਵਿੱਚ ਅਸੀਂ ਇੱਕ ਪਿੰਡ ਦੀ ਖੇਡ ਨੂੰ ਦੂਜੇ ਪਿੰਡ ਲੈ ਕੇ ਜਾ ਕੇ ਲੋਕਾਂ ਨੂੰ ਸਿਖਾ ਸਕਦੇ ਹਾਂ ਅਤੇ ਉਹਦੇ ਬਾਰੇ ਅਸੀਂ ਇੱਕ ਖੇਡ ਨੂੰ ਪੂਰੇ ਸੰਸਾਰ ਦੇ ਵਿੱਚ ਫੈਲਾ ਸਕਦੇ ਹਾਂ ਕਿਸੇ ਨੂੰ ਰੀਪ੍ਰਜੈਂਟ ਕਰਕੇ ਕਿ ਅਸੀਂ ਇਹ ਖੇਡ ਖੇਡਦੇ ਹਾਂ